ਪਹਿਲੇ ਸਮੇਂ ਵਿੱਚ ਅਤੇ ਅੱਜ ਦੇ ਸਮੇਂ ਵਿੱਚ ਵੀ ਦੁੱਧ ਗਾਈ ਮੱਜਾ ਅਤੇ ਹੋਰ ਬੱਕਰੀ ਤੋਂ ਚੋਇਆ ਜਾਂਦਾ ਹੈ ਦੁੱਧ ਚੋਣ ਦੇ ਪਰ ਤਰੀਕੇ ਅੱਜ ਕੱਲ ਵੱਖ ਵੱਖ ਨੇ ਅੱਜ ਦੇ ਸਮੇਂ ਵਿੱਚ ਲੋਕ ਆਪਣਾ ਸਮਾਂ ਵਿਅਰਥ ਨਹੀਂ ਕਰਨਾ ਪਸੰਦ ਕਰਦੇ ਉਹ ਆਪਣਾ ਕੰਮ ਜਲਦੀ ਤੋਂ ਜਲਦੀ ਖਤਮ ਕਰਨਾ ਪਸੰਦ ਕਰਦੇ ਹਨ ਦੁੱਧ ਚੋਣ ਦੀਆ ਕਈ ਕਈ ਤਕਨੀਕਾਂ ਅਤੇ ਕਈ ਕਈ ਤਰੀਕੇ ਹਨ ਜਿਵੇਂ ਕਿ ਅੱਜ ਕੱਲ ਪਰੰਪਰਾਗਤ ਤਰੀਕਾ ਸਰਲ ਵਰਤਿਆ ਜਾਂਦਾ ਹੈ ਜਿਸ ਤੋਂ ਕਿਸਾਨਾਂ ਦਾ ਹੱਥੀ ਕੰਮ ਘੱਟ ਜਾਵੇ ਕਿਸਾਨ ਆਪਣੇ ਹੱਥ ਦੀ ਮਦਦ ਨਾਲ ਨਿਜਰਾ ਨੂੰ ਦਬਾਉਣੇ ਹਨ ਜਿਸ ਨਾਲ ਦੁੱਧ ਨਿਕਲਦਾ ਹੈ ਇਹ ਵਿਅਕਤੀਗਤ ਪਸ਼ੂਆ ਲਈ ਵਧੀਆ ਹੁੰਦਾ ਹੈ ਪਰ ਵੱਡੇ ਪੱਧਰ ਤੇ ਇਸ ਤਰੀਕੇ ਨਾਲ ਕੰਮ ਕਰਨਾ ਔਖਾ ਹੋ ਜਾਂਦਾ ਹੈ ਇਹ ਤਕਨੀਕ ਇਹ ਤਰੀਕਾ ਅੱਜ ਕੱਲ ਲੋਕ ਪੁਰਾਣਾ ਸਮੇਂ ਦੇ ਹਨ ਇਸ ਕਰਕੇ ਲੋਕ ਤਕਨੀਕੀ ਵੱਡੇ ਡਾਇਰੀ ਫਾਰਮਾਂ ਵਿੱਚ ਵਰਤੀ ਜਾਂਦੀ ਮਸ਼ੀਨਾ ਦਾ ਵਰਤੋਂ ਕਰਨਾ ਜਿਆਦਾ ਪਸੰਦ ਕਰਦੇ ਹਨ ਇਹ ਤਰੀਕਾ ਸਮੇਂ ਦੀ ਬਚਤ ਕਰਦਾ ਹੈ ਅਤੇ ਦੁੱਧ ਦੀ ਗੁਣਵੰਤਾ ਨੂੰ ਬਣਾਈ ਰੱਖਦਾ ਹੈ ਅੱਜ ਕੱਲ ਰੋਬੋਟਿਕ ਮਿਲਕਿੰਗ ਅਤੇ ਆਟੋਮੈਟਿਕ ਮਿਲਕ ਮਸ਼ੀਨਾਂ ਉਪਲਬਧ ਹਨ ਜਿਸ ਨਾਲ ਸਮਾਂ ਵਿਅਰਥ ਨਹੀਂ ਹੁੰਦਾ ਆਧੁਨਿਕ ਡੈਰੀਆ ਵਿੱਚ ਰਬੋਰਡਿਕ ਮਿਸਟ ਅਸਿਸਟਮ ਦੁੱਧ ਚੋਣ ਲਈ ਵਰਤੇ ਜਾਂਦੇ ਹਨ ਇਹ ਸਿਸਟਮ ਪਸ਼ੂਆਂ ਨੂੰ ਸ਼ਨ ਕਰਦੇ ਹਨ ਇਹ ਤਕਨੀਕੀ ਨਾਲ ਵਿਅਕਤੀਗਤ ਮਦਦ ਦੀ ਘੱਟ ਲੋੜ ਹੁੰਦੀ ਹੈ ਅਤੇ ਉਪਾਦਨ ਵੱਧ ਜਾਂਦਾ ਹੈ ਇਸ ਕਰਕੇ ਅੱਜ ਦੇ ਸਮੇਂ ਵਿੱਚ ਮਸ਼ੀਨੀ ਆਟੋਮੈਟਿਕ ਰੋਬੋਟਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਦੁੱਧ ਨੂੰ ਚੋਣ ਲਈ